ਮੇਰੀ ਚਲਦੀ ਰੂਟੀਨ ਵਿੱਚ ਤਾਕਤ ਅਤੇ ਲਚਕਤਾ ਨੂੰ ਸਿਖਲਾਈ ਨੂੰ ਦੇਣ ਲਈ ਮੇਰਾ ਬਾਪੂ ਬਹੁਤ ਹੀ ਯੋਗਦਾਨ ਪਾ ਰਿਹਾ ਹੈ ਮੇਰਾ ਬਾਪੂ ਇੱਕ ਸੂਬੇਦਾਰ ਰਿਟਾਇਰ ਆਫਸਰ ਹੈ ਉਹ ਮੈਨੂੰ ਡੇਲੀ ਜਲਦੀ ਉਠਾ ਦਿੰਦਾ ਹੈ ਕਿ ਉੱਠ ਤੂੰ ਦੌੜ ਲਾ ਅਤੇ ਆਪਣੇ ਸਰੀਰ ਨੂੰ ਢਿੱਲਾ ਨਾ ਛੱਡ ਤਾਂ ਜੋ ਤੇਰਾ ਸਰੀਰ ਇੱਕ ਵਾਧੂ ਦੀ ਚੀਜ਼ ਬਣ ਕੇ ਰਹਿ ਜਾਏ ਇਸਨੂੰ ਲਚਕਤਾ ਭਰਪੂਰ ਰੱਖ ਅਤੇ ਡੇਲੀ ਦੌੜ ਲਾ ਡੰਡ ਬੈਠਕਾ ਲਾ ਅਤੇ ਮੈਨੂੰ ਉਹ ਡੇਲੀ ਸਿਖਲਾਈ ਦਿੰਦਾ ਹੈ ਅਤੇ ਮੇਰੇ ਸਰੀਰ ਦੀ ਉਹ ਉਹਨਾਂ ਕਰਕੇ ਹੀ ਮੇਰੀ ਲਚਕਤਾ ਪੂਰੀ ਬਣੀ ਰਹੀ ਹੈ ਹੁਣ ਤੱਕ ਇਸ ਲਈ ਮੈਂ ਪੂਰਾ ਫਿੱਟ ਹਾਂ ਅਤੇ ਮੈਂ ਇਹ ਯੋਗਦਾਨ ਬਾਪੂ ਦਾ ਆਪਣੀ ਜਿੰਦਗੀ 'ਚ ਕਦੇ ਨਹੀਂ ਭੁੱਲ ਸਕਦਾ